ਹਾਂ ਮੈਨੂੰ ਗਾਹਕਾਂ ਕੋਲੋਂ ਬਹੁਤ ਅੱਛੀ ਫੀਡਬੈਕ ਮਿਲੀ ਹੈ ਮੈਂ ਆਪਣੇ ਸਵੈਟਰ ਬਣਾ ਕੇ ਹੱਥ ਨਾਲ ਉੱਨ ਵਾਲੇ ਸਿਲਾਈਆਂ 'ਤੇ ਬਣਾ ਕੇ ਵੇ ਵੇਚੇ ਹਨ ਅਤੇ ਮੈਨੂੰ ਬਹੁਤ ਅੱਛੀ ਫੀਡਬੈਕ ਮਿਲੀ ਸਾਰੇ ਕਹਿੰਦੇ ਨੇ ਕਿ ਤੁਸੀਂ ਬਹੁਤ ਅੱਛਾ ਬਣਾਉਂਦੇ ਹੋ ਤੁਹਾਡੇ ਹੱਥਾਂ ਦੀ ਤੁਹਾਡੀ ਸਿਲੈਕਸ਼ਨ ਬਹੁਤ ਅੱਛੀ ਹੈ ਤੁਸੀਂ ਅੱਛੇ ਅੱਛੇ ਕਲਰ ਦੇ ਅੱਛੇ ਅੱਛੇ ਵਧੀਆ ਬਣਾ ਕੇ ਸਾਨੂੰ ਦਿੱਤੇ ਹੈ ਇਸ ਲਈ ਮੈਂ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਜਿਹੜੇ ਆਪਣੇ ਸਾਡੇ ਰੈਲੇਟਿਵ ਹੈ ਮੈਂ ਉਨ੍ਹਾਂ ਨੂੰ ਵੀ ਕੱਪੜੇ ਵੀ ਸੀ ਕੇ ਦਿੱਤੇ ਹੈ ਮੈਂ ਕੱਪੜੇ ਵੀ ਸੀ ਲੈਂਦੀ ਹਾਂ ਅਤੇ ਮੈਨੂੰ ਬੱਚੇ ਮੇਰੇ ਬਹੁਤ ਮੇਰੀ ਤਰੀਫ਼ ਕਰਦੇ ਹਨ ਅਤੇ ਮੇਰੇ ਹੋਰ ਵੀ ਭਰਾ ਭਰਜਾਈ ਮੇਰੀ ਮੇਰੀ ਭੈਣ ਸਾਰਿਆਂ ਨੂੰ ਮੈਂ ਆਪਣੇ ਹੱਥੀਂ ਬਣਾ ਕੇ ਸੂਟ ਵੀ ਦਿੱਤੇ ਹਨ ਉਹ ਮੇਰੀ ਬਹੁਤ ਸਿਫ਼ਤ ਕਰਦੇ ਨੇ ਕਿ ਦੀਦੀ ਤੁਸੀਂ ਬਹੁਤ ਅੱਛੇ ਇਤਨੇ ਅੱਛੇ ਕਿੱਥੋਂ ਸਿਲੈਕਟ ਕਰਦੇ ਹੋ ਅਤੇ ਤੁਹਾਨੂੰ ਸਾਨੂੰ ਵੀ ਇਹ ਸਿਖਾਓ ਅਸੀਂ ਵੀ ਤੁਹਾਡੇ ਕੋਲੋਂ ਸਿੱਖਣਾ ਚਾਂਦੇ ਅਸੀਂ ਵੀ ਤੁਹਾਡੇ ਹੁਨਰ ਦੇ ਬਹੁਤ ਮੁਰੀਦ ਹੈ ਅਤੇ ਸਾਨੂੰ ਵੀ ਸਿਖਾਓ ਤੁਸੀਂ ਇੰਨੇ ਅੱਛੇ ਅੱਛੇ ਕਿੱਦਾਂ ਬਣਾ ਲੈਂਦੇ ਹੈ ਅਤੇ ਓ ਬਾਕੀ ਮੈਂ ਸਵੈਟਰ ਅਤੇ ਸੂਟ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਆਪ ਸਿੱਖੀਆਂ ਨੇ ਆਪਣੀ ਮੰਮੀ ਕੋਲੋਂ ਸਿੱਖੀਆਂ ਹੈ ਅਤੇ ਅੱਗੇ ਫੇਰ ਮੈਂ ਉਹਨੂੰ ਆਪ ਮੇਰੀ ਮੰਮੀ ਨੇ ਮੈਨੂੰ ਸਿਖਾਈਆਂ ਸੀਗੀਆਂ ਅਤੇ ਮੈਂ ਸਵੈਟਰ ਵੀ ਬਹੁਤ ਅੱਛੇ ਬਣਾ ਲੈਂਦੀ ਹੈ ਅਤੇ ਸੂਟ ਵੀ ਬਹੁਤ ਅੱਛੇ ਸੀ ਲੈਂਦੀ ਹੈ